ਹੈਲੋ ਸਰ ਕੀ ਤੁਸੀਂ ਚੱਕੀ ਸਵੀਟ ਤੋਂ ਬੋਲ ਰਹੇ ਹੋ ਕੁਲਵੰਤ ਸਿੰਘ ਮੈਂ ਸਿਮਰਨ ਕੌਰ ਬੋਲ ਰਹੀ ਹਾਂ ਮੈਂ ਪਟਿਆਲੇ ਤੋਂ ਗੱਲ ਕਰ ਰਹੀ ਹਾਂ ਹਾਂਜੀ ਸਰ ਤੁਹਾਡੀ ਸ਼ੋਪ ਬਹੁਤ ਮਸ਼ਹੂਰ ਹੈ ਤੁਹਾਡੀ ਸ਼ੋਪ ਦਾ ਹਰ ਚੀਜ਼ ਬਹੁਤ ਹੀ ਸਵਾਦ ਹੁੰਦੀ ਹੈ ਇਸ ਲਈ ਮੈਂ ਤੁਹਾਡੀ ਸ਼ੋਪ ਤੋਂ ਕੁਝ ਚੀਜ਼ਾਂ ਓਰਡਰ ਕੀਤੀਆਂ ਸੀ ਗੁਲਾਬ ਜਾਮਨਾਂ ਰਸਗੁੱਲੇ ਗੋਲਗੱਪੇ ਰਸਮਲਾਈ ਆਦਿ ਤੁਹਾਡੀ ਸ਼ੋਪ ਦੀ ਹਰ ਇੱਕ ਚੀਜ਼ ਹੀ ਬਹੁਤ ਸਵਾਦ ਹੁੰਦੀ ਹੈ ਤੁਹਾਡੀ ਦੁਕਾਨ ਬਹੁਤ ਮਸ਼ਹੂਰ ਹੈ ਸਾਰੇ ਪਟਿਆਲੇ ਵਿੱਚੋਂ ਤੁਹਾਡੀ ਸ਼ੋਪ ਨੰਬਰ ਵਨ ਹੈ ਇਸ ਲੀਏ ਤੁਹਾਡੀ ਦੁਕਾਨ ਦੇ ਹਰ ਇੱਕ ਚੀਜ਼ ਬਹੁਤ ਲਾਜਵਾਬ ਹੁੰਦੀ ਹੈ ਐਕਚੁਲੀ ਸਾਡੇ ਘਰ ਕੁਛ ਮਹਿਮਾਨਾਂ ਨੇ ਆਉਣਾ ਸੀ ਇਸ ਲਈ ਮੈਂ ਤੁਹਾਡੀ ਸ਼ੋਪ ਤੋਂ ਬਹੁਤ ਚੀਜਾਂ ਓਰਡਰ ਕੀਤੀਆਂ ਮੈਨੂੰ ਓਰਡਰ ਕਰਦੇ ਸਮੇਂ ਪਤਾ ਲੱਗਿਆ ਕਿ ਤੁਸੀਂ ਡਿਸਕਾਊਂਟ ਵਗੈਰਾ ਵੀ ਬਹੁਤ ਅੱਛਾ ਦਿੰਦੇ ਹੋ ਅਤੇ ਇਸ ਕਰਕੇ ਮੈਂ ਤੁਹਾਡੀ ਸ਼ੋਪ ਤੋਂ ਓਰਡਰ ਕਰਨਾ ਚਾਹਿਆ ਸਾਡੇ ਘਰ ਅੱਜ ਬਹੁਤ ਸਾਰੇ ਮਹਿਮਾਨਾਂ ਨੇ ਆਉਣਾ ਸੀ ਇਸ ਲੀਏ ਖਾਣ ਪੀਣ ਦਾ ਸਮਾਨ ਅਸੀਂ ਤੁਹਾਡੀ ਹੀ ਦੁਕਾਨ ਤੋਂ ਓਰਡਰ ਕੀਤਾ ਮੈਨੂੰ ਇਵੇਂ ਲੱਗਿਆ ਕਿ ਤੁਹਾਡੀ ਸ਼ੋਪ ਦੀ ਬਹੁਤ ਵਧੀਆ ਚੀਜ਼ਾਂ ਹਨ ਤੁਸੀਂ ਸਾਫ ਸੁਥਰੀਆਂ ਚੀਜ਼ਾਂ ਬਣਾਉਂਦੇ ਹਨ ਸਫਾਈ ਦਾ ਖਾਸ ਕਰਕੇ ਧਿਆਨ ਰੱਖਦੇ ਹੋ ਇਸ ਲਈ ਤੁਹਾਡੀ ਚੀਜ਼ ਖਰੀਦਣ ਸਮੇਂ ਸਾਨੂੰ ਝਿਜਕਝਾਣਾ ਨਹੀਂ ਪੈਂਦਾ ਤੁਹਾਡੇ ਦੁਕਾਨ ਦੇ ਰ ਰਸਗੁੱਲੇ ਅਤੇ ਰਸਮਲਾਈ ਬਹੁਤ ਹੀ ਜ਼ਿਆਦਾ ਸਵਾਦ ਹੁੰਦੀ ਹੈ ਗੋਲਗੱਪੇ ਤਾਂ ਬਹੁਤ ਹੀ ਜ਼ਿਆਦਾ ਸਵਾਦ ਹੁੰਦੇ ਹਨ ਇਸ ਲਈ ਅਸੀਂ ਤੁਹਾਡੀ ਦੁਕਾਨ ਤੋਂ ਬਹੁਤ ਕੁਝ ਚੀਜ਼ਾਂ ਓਰਡਰ ਕੀਤੀਆਂ ਅਤੇ ਹੁਣ ਸਾਨੂੰ ਇਹ ਦੱਸਦੇ ਹੋਏ ਬੜੀ ਸ਼ਰਮਿੰਦਗੀ ਹੋ ਰਹੀ ਹੈ ਕਿ ਜੋ ਸਾਡੇ ਘਰ ਮਹਿਮਾਨ ਆਉਣੇ ਸੀ ਉਹ ਕਹਿੰਦੇ ਕਿ ਸਾਨੂੰ ਇਹ ਦਕ ਬਾਹਰਲੀ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ ਕਿ ਅੱਜ ਕੱਲ੍ਹ ਜ ਦ ਘਰ ਦਾ ਖਾਣਾ ਹੀ ਪਸੰਦ ਆਉਂਦਾ ਹੈ ਇਸ ਲਈ ਸ ਮੈਨੂੰ ਇਹ ਦੱਸਦੇ ਹੋਏ ਦੁੱਖ ਹੁੰਦਾ ਹੈ ਕਿ ਮੈਂ ਜੋ ਓਰਡਰ ਕੀਤਾ ਸੀ ਉਹ ਰੱਦ ਕਰਨਾ ਚਾਹੁੰ ਦੀ ਹਾਂ ਅਤੇ ਕਿਰਪਾ ਤੁਸੀਂ ਇਹ ਓਰਡਰ ਰੱਦ ਕਰ ਦਿਉ ਅਤੇ ਕਿਰਪਾ ਕਰਕੇ ਮੇਰੇ ਪੈਸੇ ਵਾਪਸ ਦਿੱਤੇ ਜਾਣ